ਦੌੜਨ ਨਾਲ ਜਾਂ ਹੋਰ ਵੀ ਆਊਟਡੋਰ ਐਕਟੀਵਿਟੀਜ਼ ਕਰਨ ਨਾਲ ਸਾਡੀ ਮਾਨਸਿਕ ਸਿਹਤ ਅਤੇ ਤੰਦਰੁਸਤੀ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਕਈ ਲੋਕਾਂ ਨੂੰ ਸੈਰ ਕਰਨਾ ਪਸੰਦ ਹੁੰਦਾ ਹੈ ਕਈ ਲੋਕ ਸਾਈਕਲਿੰਗ ਵੀ ਕਰਦੇ ਹਨ ਤਾਂ ਕਈ ਦੌੜਾਂ ਦੇ ਸ਼ੌਕੀਨ ਹਨ ਮੈਨੂੰ ਪੁੱਛਣੀ ਦੌੜਨਾ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਅਸੀਂ ਦੌੜਦੇ ਹਾਂ ਤਾਂ ਸਿਰਫ਼ ਸਾਡੀ ਸਿਹਤ 'ਤੇ ਅਸਰ ਨਹੀਂ ਪੈਂਦਾ ਸਾਡੀ ਬੋਡੀ ਬਹੁਤ ਹੀ ਆਰਾਮ ਮਹਿਸੂਸ ਕਰਦੀ ਹੈ ਸਾਡਾ ਮਨ ਸ਼ਾਂਤ ਹੁੰਦਾ ਹੈ ਮੈਨੂੰ ਦੌੜਨਾ ਬਹੁਤ ਹੀ ਪਸੰਦ ਹੈ ਮੈਂ ਸਕੂਲ ਵਿੱਚ ਵੀ ਕਈ ਦੌੜਾਂ ਵਾਲੀਆਂ ਐਕਟੀਵਿਟੀਜ਼ ਵਿੱਚ ਪਾਰਟੀਸੀਪੇਟ ਕੀਤਾ ਅਤੇ ਉਸ ਵਿੱਚੋਂ ਵੀ ਮੈਂ ਫਸਟ ਪੋਜੀਸ਼ਨ ਲੈ ਪਾਈ ਮੈਨੂੰ ਦੌੜਨ ਨਾਲ ਬਹੁਤ ਹੀ ਸ਼ਾਂਤੀ ਮਿਲਦੀ ਹੈ ਅਤੇ ਮੇਰੇ ਮਨ ਉੱਤੇ ਵਧੀਆ ਪ੍ਰਭਾਵ ਪੈਂਦਾ ਕਈ ਲੋਕ ਸੈਰ ਕਰਦੇ ਹਨ ਉਹ ਸਵੇਰੇ ਤੜਕੇ ਪੰਜ ਵਜੇ ਉੱਠ ਕੇ ਸੈਰ ਕਰਨ ਲਈ ਜਾਂਦੇ ਹਨ ਸਵੇਰੇ ਕੋਈ ਰੌਲਾ ਨਹੀਂ ਹੁੰਦਾ ਬਲਕਿ ਪੰਛੀਆਂ ਦੀਆਂ ਸੁੰਦਰ ਜਿਹੀਆਂ ਆਵਾਜ਼ਾਂ ਆਉਂਦੀਆਂ ਹਨ ਇਸ ਨਾਲ ਅਸੀਂ ਨੇਚਰ ਨਾਲ ਜੁੜੇ ਰਹਿੰਦੇ ਹਾਂ ਇਸ ਲਈ ਸਾਨੂੰ ਦੌੜਨਾ ਚਾਹੀਦਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਹੈ